ਹਾਂਜੀ ਸਾਡੇ ਪਿੰਡ ਵਿੱਚ ਇੱਕ ਸਕੂਲ ਹੈ ਜਿੱਥੇ ਸਾਨੂੰ ਵੱਖ ਵੱਖ ਕਲਾ ਰੂਪਾਂ ਵਿੱਚ ਸ਼ਿਲਪਕਾਰੀ ਕਰਨੀ ਸਿਖਾਈ ਜਾਂਦੀ ਹੈ ਜੇ ਮੈਂ ਗੱਲ ਕਰਾਂ ਡਰਾਇੰਗ ਵਿਸ਼ੇ ਦੀ ਤਾਂ ਸਾਨੂੰ ਸਕੂਲਾਂ ਵਿੱਚ ਡਰਾਇੰਗ ਵਿਸ਼ਾ ਰਖਾਇਆ ਜਾਂਦਾ ਹੈ ਉਸ ਤੋਂ ਉੱਪਰ ਪੇਂਟਿੰਗ ਕਰਨੀ ਤਾਂ ਬੱਚੇ ਪੇਂਟ ਕਰਨ ਲਈ ਵੱਖ ਵੱਖ ਕਲਰ ਦੀ ਵਰਤੋਂ ਕਰਦੇ ਹਨ ਅਤੇ ਆਪਣੀ ਸ਼ਿਲਪਕਾਰੀ ਨੂੰ ਹੋਰ ਜੋ ਹੈ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜੇ ਮੈਂ ਗੱਲ ਕਰਾਂ ਆਈ ਟੀ ਆਈ ਦੀ ਤਾਂ ਸਾਡੇ ਨੇੜੇ ਹੀ ਇੱਕ ਆਈ ਟੀ ਆਈ ਆਈ ਟੀ ਆਈ ਹੈ ਜਿਸ ਵਿੱਚ ਸਾਨੂੰ ਇੱਕ ਆਰਟ ਐਂਡ ਕਰਾਫਟ ਦਾ ਕੋਰਸ ਕਰਵਾਇਆ ਜਾਂਦਾ ਹੈ ਉਸ ਵਿੱਚ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਪੇਂਟਿੰਗਸ ਬਣਾਉਣਾ ਸੀਨਰੀਆਂ ਬਣਾਉਣੀਆਂ ਆਦਿ ਸਿਖਾਈਆਂ ਜਾਂਦੀਆਂ ਹਨ ਜਿੱਦਾਂ ਅਸੀਂ ਆਪਣੇ ਘਰ ਦੀ ਸਜਾਵਟ ਕਰਨ ਲਈ ਹੈ ਕਿ ਜੋ ਰਬੜ ਦੀਆਂ ਬੋਤਲਾਂ ਹੁੰਦੀਆਂ ਨੇ ਉਹ ਕਿੱਦਾਂ ਫਲਾਵਰ ਤਿਆਰ ਕਰਨੇ ਨੇ ਉਹਨਾਂ ਨੂੰ ਪੇਂਟ ਕਰਨਾ ਉਹਨਾਂ ਉੱਪਰ ਸ ਸਿੱਪੀਆਂ ਸਿਤਾਰੇ ਲਗਾ ਕੇ ਉਹਨਾਂ ਨੂੰ ਬਹੁਤ ਵਧੀਆ ਅਕਰਸ਼ਕ ਤਰੀਕੇ ਨਾਲ ਬਣਾਉਣਾ ਆਦਿ ਕਰਵਾਇਆ ਜਾਂਦਾ ਹੈ ਜੇ ਮੈਂ ਗੱਲ ਕਰਾਂ ਕਲਾਕਾਰੀ ਦੀ ਤਾਂ ਜਿੱਦਾਂ ਹੱਥ ਨਾਲ ਵੀ ਅਸੀਂ ਕਲਾਕਾਰੀ ਕਰ ਸਕਦੇ ਹਾਂ ਸਾਨੂੰ ਫੁਲਕਾਰੀ ਕੱਢਣੀ ਸਿਖਾਈ ਜਾਂਦੀ ਹੈ ਅਸੀਂ ਵੱਖ ਵੱਖ ਰੰਗਾਂ ਦੀਆਂ ਰੀਲਾਂ ਦੀ ਵਰਤੋਂ ਕਰਕੇ ਉਹਦੇ ਨਾਲ ਜਿਹੜੀ ਫੁਲਕਾਰੀ ਨੂੰ ਆਪਣੀ ਨੂੰ ਬਹੁਤ ਹੀ ਸੁੰਦਰ ਬਣਾ ਸਕਦੇ ਹਾਂ ਜੇ ਮੈਂ ਗੱਲ ਕਰਾਂ ਆਪਣੇ ਸਿਲਾਈ ਕਢਾਈ ਦੀ ਤਾਂ ਸਿਲਾਈ ਕਢਾਈ ਵਿੱਚ ਸਾਨੂੰ ਵੱਖ ਵੱਖ ਤਰ੍ਹਾਂ ਦੇ ਕੱਪੜਿਆਂ ਦੇ ਵੱਖ ਵੱਖ ਤਰ੍ਹਾਂ ਦੇ ਡਿਜ਼ਾਇਨ ਬਣਾਉਣਾ ਸਿਖਾਇਆ ਜਾਂਦਾ ਹੈ ਜਿੱਦਾਂ ਆਪਾਂ ਜੈਕਟ ਬਣਾਉਣੀ ਆ ਗਲੇ ਉੱਪਰ ਡਿਜ਼ਾਇਨ ਪਾਉਣੇ ਬਾਹਾਂ ਉੱਪਰ ਡਿਜਾਇਨ ਪਾਉਣੇ ਸੂਟ ਤਿਆਰ ਕਰਨੇ ਸੂਟ 'ਤੇ ਕਢਾਈ ਕਰਨੀ ਮੋਤੀ ਸਿੱਪੀਆਂ ਸਿਤਾਰੇ ਆਦਿ ਲਗਾ ਕੇ ਸੂਟ ਨੂੰ ਕਿੱਦਾਂ ਬਹੁਤ ਹੀ ਸੋਹਣਾ ਬਣਾਉਣਾ ਉਹਨਾਂ ਉੱਪਰ ਆਪਣਾ ਡਿਜ਼ਾਇਨ ਤਿਆਰ ਕਰਨਾ ਇੱਕ ਸਾਫ ਸੂਟ ਤੋਂ ਉਹਨਾਂ ਉੱਪਰ ਡਿਜ਼ਾਇਨਿੰਗ ਕਰਕੇ ਉਹਨਾਂ ਨੂੰ ਬਹੁਤ ਹੀ ਅਕਰਸ਼ਕ ਤਰੀਕੇ ਨਾਲ ਬਣਾਉਣਾ ਇਸ ਤਰੀਕੇ ਦੀਆਂ ਜਿਹੜੀਆਂ ਉਹ ਕਲਾਕਾਰੀਆਂ ਕਰ ਸਕਦੇ ਹਾਂ